ਸੋਲ੍ਹਾਂ ਨਵੰਬਰ ਦੋ ਹਜ਼ਾਰ ਦਸ ਵੀਹ ਜਨਵਰੀ ਉੱਨੀ ਸੌ ਨੱਬੇ ਇੱਕ ਫਰਵਰੀ ਉੱਨੀ ਸੌ ਪਚਾਨਵੇਂ ਅਠਾਰ੍ਹਾਂ ਅਗਸਤ ਉੱਨੀ ਸੌ ਪੰਜਾਹ ਉਣੱਤੀ ਦਸੰਬਰ ਦੋ ਹਜ਼ਾਰ ਬਾਈ